ਪੰਜਾਬ ਵਿੱਚ ਨਿੱਜੀ ਸਿਹਤ ਸੰਭਾਲ ਲਈ ਕਈ ਤਰ੍ਹਾਂ ਦੇ ਪ੍ਰਾਈਵੇਟ ਕਾਰਪੋਰੇਟ ਹਸਪਤਾਲ ਹਨ ਜਿਵੇਂ ਕਿ ਫੋਟੀਸ ਹੋਸਪਿਟਲ ਹੈ ਜਾਂ ਕੋਈ ਲੋਕਲ ਲੈਵਲ 'ਤੇ ਜਿਸ ਤਰ੍ਹਾਂ ਹਰਤੇਜ ਜਾਂ ਹੋਸਪਿਟਲ ਹੈ ਜਾਂ ਕਈ ਜਗ੍ਹਾ 'ਤੇ ਜਨਤਾ ਹੋਸਪਿਟਲ ਵੀ ਹਨ ਉਹਨਾਂ ਦੀ ਜਿਹੜੀ ਫੈਸਿਲਿਟੀ ਹੈ ਉਹ ਉਹਨਾਂ ਦੇ ਜੋ ਕਾਰਗੁਜ਼ਾਰੀ ਹੈ ਉਹਦੇ 'ਤੇ ਨਿਰਭਰ ਕਰਦਾ ਹੈ ਰੇਟਸ ਵਗੈਰਾ ਵੀ ਅਲੱਗ ਅਲੱਗ ਹੁੰਦੇ ਹਨ ਜਿਹੜੇ ਕਿ ਐਕਸ ਜਿਹੜੇ ਉਹ ਅਗਲੇ ਉਹ ਕਰਦੇ ਨੇ ਡਾਇਗਨੋਸਟਿਕ ਚੀਜ਼ਾਂ ਦੀਆਂ ਮਸ਼ੀਨਾਂ ਦੇ ਨਾਲ ਉਹਨਾਂ ਦੇ ਵੀ ਰੇਟ ਅਲੱਗ ਅਲੱਗ ਹੁੰਦੇ ਹਨ ਔਰ ਇਸ ਤੋਂ ਜਿਆਦਾ ਜਿਹੜੇ ਕਿ ਸਰਕਾਰੀ ਹਸਪਤਾਲ ਹਨ ਉਹਦੇ ਵਿੱਚ ਬਹੁਤ ਵਾਜਿਬ ਰੇਟ ਹੁੰਦੇ ਹਨ ਔਰ ਉੱਥੇ ਸਾਫ਼ ਸਫਾਈ ਦਾ ਵੀ ਚੱਕਰ ਪੈ ਜਾਂਦਾ ਹੈ ਜਿਹਦੇ ਕਰਕੇ ਲੋਕ ਉੱਥੇ ਜਾਣਾ ਪਸੰਦ ਨਹੀਂ ਕਰਦੇ ਬੇਸ਼ੱਕ ਜਿਸਦੇ ਕੋਈ ਬਿਮਾਰ ਹੁੰਦਾ ਹੈ ਜਾਂ ਕੋਈ ਐਮਰਜੈਂਸੀ ਟ੍ਰੀਟਮੈਂਟ ਦੀ ਜ਼ਰੂਰਤ ਹੁੰਦੀ ਹੈ ਉਹ ਜਿਹੜੇ ਇਹ ਪ੍ਰਾਈਵੇਟ ਹੋਸਪਿਟਲ ਹਨ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਵਧੀਆ ਅਤੇ ਸੁਚਾਰੂ ਹੋਣ ਕਰਕੇ ਸਾਫ਼ ਸਫਾਈ ਦਾ ਪਰੋ ਪੂਰਾ ਇੰਤਜ਼ਾਮ ਹੋਣ ਕਰਕੇ ਲੋਕ ਉੱਥੇ ਜਾਣਾ ਪਸੰਦ ਕਰਦੇ ਹਨ ਤਾਂ ਕਿ ਆਪਣਾ ਸਹੀ ਟਾਈਮ ਸਿਰ ਔਰ ਅੱਛੇ ਤਰੀਕੇ ਨਾਲ ਇਲਾਜ ਕਰਾ ਸਕਣ ਜਦੋਂ ਕਿ ਵੇਟਿੰਗ ਪੀਰੀਅਡ ਦੀ ਜਿਹੜੀ ਗੱਲ ਹੈ ਉਹ ਸਰਕਾਰੀ ਹਸਪਤਾਲਾਂ 'ਚ ਬਹੁਤ ਜ਼ਿਆਦਾ ਦਿੱਕਤ ਦਿੰਦੀ ਹੈ ਕਈ ਵਾਰੀ ਤਾਂ ਡੋਕਟਰ ਟਾਈਮ ਸਿਰ ਨਹੀਂ ਪਹੁੰਚਦੇ ਅਤੇ ਦਵਾਈਆਂ ਵੀ ਨਹੀਂ ਮਿਲਦੀਆਂ ਉਹ ਕਈ ਤਰ੍ਹਾਂ ਦੀਆਂ ਮਸ਼ੀਨਾਂ ਖ਼ਰਾਬ ਵੀ ਰਹਿੰਦੀਆਂ ਹਨ